ਹੈਲੋ ਹੈਲੋ ਹਾਂਜੀ ਤੁਸੀਂ ਸਬਜ਼ੀ ਬਣਾਈ ਸੀਗੀ ਨਾ ਵਧੀਆ ਨਹੀਂ ਸੀ ਬਣੀ ਸਬਜ਼ੀ ਨਾ ਮੇਰੇ ਬੇਟੇ ਨੇ ਤਾਂ ਰੋਟੀ ਨਹੀਂ ਖਾਦੀ ਅੱਜ ਨਿਊਟਰੀ ਨੂੰ ਕੀ ਹੋਇਆ ਸੀਗਾ ਨਾ ਖਾਧੀ ਨਹੀਂ ਪਸੰਦ ਨਹੀਂ ਉਹਦੇ ਆਈ ਨਮਕ ਜ਼ਿਆਦਾ ਪਾਉਂਦੇ ਆ ਤੁਸੀਂ ਰਾਤ ਤੁਹਾਡੀ ਰਾਤ ਕੜ੍ਹੀ ਬਣਾਈ ਸੀ ਕੜ੍ਹੀ ਵੀ ਨਹੀਂ ਸਵਾਦ ਬਣੀ ਤੁਸੀਂ ਕੜੀ ਪੱਤਾ ਨਹੀਂ ਪਾਉਂਦੇ ਹੁੰਦੇ ਵਿੱਚ ਅੱਛਾ ਅਤੇ ਨਿਊਟਰੀ ਉਹ ਕਾਹਦੇ 'ਚ ਬਣਾਈ ਸੀਗੀ ਟੇਸਟ ਹੀ ਨਹੀਂ ਸੀ ਜਮਾਂ ਵੀ ਰਫੈਂਡ 'ਚ ਤਾਂ ਨਹੀਂ ਬਣਾਈ ਦੇਸੀ ਘਿਓ ਪਾਉਣਾ ਸੀ ਦੋ ਚਮਚ ਨਹੀਂ ਦੇਸੀ ਘਿਓ 'ਚ ਬਣਾਇਆ ਕਰੋ ਮੇਰਾ ਬੇਟਾ ਖਾਂਦਾ ਨਹੀਂ ਹੈਗਾ ਬੱਚਾ ਮੇਰਾ ਨਹੀਂ ਕੋਈ ਵੀ ਹੋਵੇ ਦੇਸੀ ਘਿਓ ਹੋਣਾ ਚਾਹੀਦਾ ਨਹੀਂ ਇੱਕ ਨਾ ਗੋਭੀ ਵੀ ਕੱਚੀ ਸੀਗੀ ਉਸ ਦਿਨ ਹਾਂਜੀ ਇੱਕ ਤੁਸੀਂ ਨਾ ਗਾਜਰਾਂ ਮਟਰ 'ਚ ਅਸੀਂ ਤਾਂ ਦੁੱਧ ਪਾ ਕੇ ਖਾਂਦੇ ਆ ਅਤੇ ਤੁਸੀਂ ਦੁੱਧ ਨਹੀਂ ਪਾਇਆ ਸੀ ਗਾਜਰਾਂ ਮਟਰ 'ਚ ਨਹੀਂ ਸਾਨੂੰ ਤਾਂ ਦੁੱਧ ਪਾ ਕੇ ਦਿਆ ਕਰੋ ਅਸੀਂ ਤਾਂ ਦੁੱਧ ਪਾ ਕੇ ਖਾਂਦੇ ਆ ਗਾਜਰ ਮਟਰ ਸਾਡੇ ਤਾਂ ਕਿਸੇ ਨੇ ਮੂੰਹ ਨਹੀਂ ਲਾਇਆ ਇੱਕ ਨਾ ਤੁਸੀਂ ਚਾਵਲ ਉਬਾਲ ਕੇ ਨਹੀਂ ਬਣਾਉਂਦੇ ਹੈਗੇ ਚਾਵਲ ਉਬਾਲ ਕੇ ਬਣਾਇਆ ਕਰੋ ਪਾਣੀ ਕੱਢ ਕੇ ਨਾ ਉਸ ਤੋਂ ਬਾਅਦ ਤੜਕਾ ਲਾਇਆ ਕਰੋ ਨਮਕੀਨ ਬਣਾਉਂਦੇ ਹਾਂ ਨਾ ਚਾਵਲ ਉਸ ਤਰ੍ਹਾਂ ਬਣਦੇ ਜੇ ਨਹੀਂ ਪਤਾ ਨਹੀਂ ਕਿ ਤੁਸੀਂ ਤਾਂ ਸਾਰਾ ਕੁਝ ਵੀ ਨਹੀਂ ਵਧੀਆ ਬਣਾਉਂਦੇ ਹੈਗੇ ਵਧੀਆ ਬਣਾਇਆ ਕਰੋ ਚਾਵਲ ਨਾ ਉਬਾਲ ਕੇ ਅੱਛਾ ਅੱਜ ਨਾ ਅੱਜ ਖੀਰ ਬਣਾਇਓ ਜੀ ਅਤੇ ਵਧੀਆ ਹੋਣੀ ਚਾਹੀਦੀ ਹੈ ਖੀਰ ਡਰਾਈ ਫਰੂਟ ਨਾ ਪਾਇਓ ਵਿੱਚ ਮੇਰਾ ਬੱਚਾ ਖਾਂਦਾ ਨਹੀਂ ਹੈਗਾ ਨਾ ਨਾ ਕਸਟਡ ਵੀ ਨਹੀਂ ਕਸਟਡ ਵੀ ਨਹੀਂ ਪਾਉਣਾ ਪਹਿਲਾਂ ਤੁਸੀਂ ਕਸਟਡ ਪਾਤਾ ਪਤਾ ਨਹੀਂ ਤਾਂ ਹੀ ਨਹੀਂ ਖਾਦੀ ਹੋਣੀ ਖੀਰ ਕਸਟਰਡ ਨਹੀਂ ਪਾਉਣਾ ਹੈਗਾ ਅੱਜ ਸਬਜ਼ੀ ਕਾਹਦੀ ਬਣਾਓਗੇ ਅੱਛਾ ਅੱਛਾ ਅੱਛਾ ਅੱਛਾ ਅੱਛਾ ਸਾਨੂੰ ਤਾਂ ਦਾਲ ਦੇ ਦਿਓ ਅਤੇ ਇੱਕ ਪਨੀਰ ਦੀ ਭੁਰਜੀ ਬਣਾ ਦਿਓ ਜੀ ਅੱਜ ਵਧੀਆ ਬਣਾਇਓ ਠੀਕ ਹੈ ਜੀ ਠੀਕ ਹੈ